ਅੱਜ ਕੱਲ੍ਹ ਪੇਂਡੂ ਲੋਕਾਂ ਨੇ ਆਪਣੇ ਵਿਰਾਸਤੀ ਸਮਾਨ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਤਰ੍ਹਾਂ ਨਾਲ ਉਹ ਬਹੁਤ ਲਾਭ ਕੰਮ ਰਹੇ ਹਨ ਤੁਹਾਡੇ ਖੇਤਰਾਂ ਵਿੱਚ ਵੀ ਕੋਈ ਇਹ ਜਿਹਾ ਕਾਰੋਬਾਰ ਸ਼ੁਰੂ ਹੋਇਆ ਹੈ ਤਾਂ ਜੋ ਕਿ ਤੁਹਾਡੀ ਵਿਰਾਸਤ ਨਾਲ ਜੁੜਿਆ ਹੋਵੇ ਹੋਇਆ ਹੈ ਹਾਂਜੀ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਅੱਜ ਕੱਲ੍ਹ ਲੋਕ ਆਪਣੀ ਵਿਰਾਸਤ ਨਾਲ ਜੁੜੇ ਸਮਾਨ ਨੂੰ ਦੁਬਾਰਾ ਬਣਾ ਕੇ ਚੰਗਾ ਲਾਭ ਕਮਾ ਰਹੇ ਹਨ ਮੇਰੇ ਖੇਤਰ ਵਿਚ ਵੀ ਕੋਈ ਕਈ ਅਜਿਹੇ ਕਾਰੋਬਾਰ ਸ਼ੁਰੂ ਹੋਏ ਸਨ ਜੋ ਸਾਡੀ ਵਿਰਾਸਤ ਨੂੰ ਸੰਭਾਲਣ ਦੇ ਨਾਲ ਨਾਲ ਲੋਕਾਂ ਲਈ ਰੁਜ਼ਗਾਰ ਵੀ ਪੈਦਾ ਕਰ ਰਹੇ ਹਨ ਇੱਥੇ ਪੁਰਾਣੇ ਪੰਜਾਬੀ ਫਰਨੀਚਰਾਂ ਜਿਵੇਂ ਕਿ ਮੰਜੇ ਪੀੜ੍ਹੀਆਂ ਅਤੇ ਸੰਦੂਕਾਂ ਰੂਪ ਵਿੱਚ ਬਣਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਪੁਰਾਣੇ ਕੱਪੜਿਆਂ ਜਿਵੇਂ ਕਿ ਫੁਲਕਾਰੀ ਅਤੇ ਬਾਗ ਨੂੰ ਵੀ ਨਵੇਂ ਡਿਜਾਈਨਾਂ ਨਾਲ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ ਕਈ ਲੋਕ ਤਾਂ ਪੁਰਾਣੇ ਪੰਜਾਬੀ ਖਾਣੇ ਅਤੇ ਪਕਵਾਨਾਂ ਨੂੰ ਵੀ ਚੰਗੇ ਢੰਗ ਨਾਲ ਬਣਾ ਕੇ ਵੇਚ ਰਹੇ ਹਨ ਇਹ ਸਾਰੇ ਕਾਰੋਬਾਰ ਨਾ ਸਿਰਫ਼ ਪੁਰਾਣੀ ਵਿਰਾਸਤ ਨੂੰ ਸਾਭ ਸਾਂਭ ਰਹੇ ਹਨ ਸਗੋਂ ਪੇਂਡੂ ਲੋਕਾਂ ਲਈ ਆਮਦਨ ਜਾਂ ਚੰਗਾ ਸਾਧਾ ਸਾਧਨ ਵੀ ਬਣਾ ਰਹੇ ਹਨ ਧੰਨਵਾਦ